ਹਾਂਜੀ ਮੈਂ ਇੱਕ ਖਾਸ ਤੌਰ 'ਤੇ ਸੁੰਦਰ ਜਾਂ ਵਿਲੱਖਣ ਚੜ੍ਹਨ ਵਾਲੇ ਸਥਾਨ ਦਾ ਵਰਣਨ ਕਰ ਸਕਦੀ ਹਾਂ ਕਸੌਲੀ ਕਸੌਲੀ ਜਿਹੜਾ ਹੈ ਉਹ ਇੱਕ ਸੁੰਦਰ ਬਹੁਤ ਹੀ ਸੁੰਦਰ ਅਤੇ ਰਮਨੀਕ ਸਥਾਨ ਹੈ ਜੋ ਕਿ ਬਾਹਰ ਤੋਂ ਜਿਹੜੇ ਪ੍ਰਯਟਕ ਜਾਂ ਵਿਦੇਸ਼ੀ ਘੁੰਮਣ ਆਉਂਦੇ ਹੈ ਉਹਨਾਂ ਦੇ ਲਈ ਵੀ ਇੱਕ ਵਧੀਆ ਘੁੰਮਣ ਦਾ ਸਥਾਨ ਹੈ ਉੱਥੇ ਬਹੁਤ ਜ਼ਿਆਦਾ ਹਰਿਆਲੀ ਹਰਿਆਈ ਹੈ ਜਿੱਥੇ ਬੰਦੇ ਦੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ ਅਤੇ ਮੈਂ ਉਹ ਜੋ ਚੜ੍ਹਾਈ ਹੈ ਉੱਥੇ ਇੱਕ ਚੜ੍ਹਾਈ ਹੈ ਜਿਹੜੀ ਉੱਥੋਂ ਉੱਪਰ ਹਨੂੰਮਾਨ ਜੀ ਦਾ ਇੱਕ ਮੰਦਰ ਹੈ ਅਤੇ ਮੈਂ ਉਹ ਚੜ੍ਹਾਈ ਹੈ ਜਿਹੜੀ ਉਹ ਚੜ੍ਹੀ ਹੈ ਅਤੇ ਉੱਪਰ ਜਾ ਕੇ ਜਿਹੜਾ ਦ੍ਰਿਸ਼ ਹੈ ਉਹ ਬਹੁਤ ਜ਼ਿਆਦਾ ਸੋਹਣਾ ਦਿਖਦਾ ਬਹੁਤ ਜ਼ਿਆਦਾ ਸੁੰਦਰ ਨਜ਼ਾਰਾ ਹੈ ਉੱਥੇ ਅਤੇ ਉੱਥੇ ਇੱਕ ਫੌਜ ਦੀ ਟੁੱਕੜੀ ਵੀ ਹੈ ਬਾਕੀ ਘੁੰਮਣ ਦੇ ਲਈ ਬਹੁਤ ਵਧੀਆ ਜਗ੍ਹਾ ਹੈ ਅਤੇ ਉਹ ਇੱਕ ਇਤਿਹਾਸਕ ਇਤਿਹਾਸਕ ਤਾਂ ਨਹੀਂ ਕਹਿ ਸਕਦੇ ਮਤਲਬ ਹਿਸਟੋਰੀਕਲ ਪਲੇਸ ਕਹਿ ਸਕਦੇ ਹਾਂ ਅਤੇ ਇੱਕ ਐਜੂਕੇਸ਼ਨਲ ਵਧੀਆ ਸਥਾਨ ਹੈ